ਮੈਂ ਜੋ ਵੀ ਲਿਖਦੀ ਹਾਂ ਉਹ ਮੈਂ ਆਪਣੀ ਦੁੱਖਾਂ ਬਾਰੇ ਜਾਂ ਆਪਣੀ ਜ਼ਿੰਦਗੀ ਬਾਰੇ ਜਾਂ ਕੋਈ ਖੁਸ਼ੀ ਬਾਰੇ ਲਿਖਦੀ ਹਾਂ ਜੋ ਕਿ ਮੈਨੂੰ ਨਹੀਂ ਲੱਗਦਾ ਵੀ ਦੂਸਰੇ ਲੇਖਕ ਇੱਦਾਂ ਕਰਦੇ ਹਨ ਕਈ ਵਾਰ ਉਹ ਕਿਸੇ ਦੀ ਝੂਠੀ ਕਹਾਣੀ ਨੂੰ ਵੀ ਲਿਖ ਕੇ ਲੋਕਾਂ ਸਾਹਮਣੇ ਪ੍ਰਦਰਸ਼ਿਤ ਕਰਦੇ ਹਨ ਜਦੋਂ ਕਿ ਮੈਂ ਅਜਿਹਾ ਨਹੀਂ ਕਰਦੀ ਹਾਂ ਮੈਂ ਜੋ ਵੀ ਕਰਦੀ ਹਾਂ ਇੱਕ ਸੱਚੀ ਘਟਨਾ ਜੋ ਕਿ ਮੇਰੇ ਨਾਲ ਵਾਪਰਦੀ ਹੈ ਉਸ ਆਧਾਰ 'ਤੇ ਹੀ ਮੈਂ ਲਿਖਦੀ ਹਾਂ ਅਤੇ ਮੈਂ ਕੁਝ ਇਤਿਹਾਸ ਬਾਰੇ ਵੀ ਲਿਖਣਾ ਚਾਹੁੰਦੀ ਹਾਂ ਇਸ ਚੀਜ਼ ਉੱਪਰ ਮੈਂ ਸੁਧਾਰ ਕਰ ਰਹੀ ਹਾਂ ਕਿ ਮੈਂ ਕੁਛ ਆਸ ਪਾਸ ਬਾਰੇ ਵੀ ਲਿਖਾਂ ਬਟ ਹੁਣ ਤੱਕ ਮੈਂ ਆਪਣੇ ਅਧਾਰਤ 'ਤੇ ਹੀ ਸਭ ਕੁਛ ਲਿਖਿਆ ਹੈ